ਮੈਂ ਐਮਾਜ਼ੋਨ ਤੋਂ ਇੱਕ ਕੁੜਤੀ ਮੰਗਵਾਈ ਜੋ ਕਿ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਆਈ ਅਤੇ ਉਹਦਾ ਕਲਰ ਤਾਂ ਇੱਕ ਵਾਰ ਧੋਤੇ 'ਤੇ ਹੀ ਨਿਕਲ ਗਿਆ ਅਤੇ ਉਹਦੀ ਫ਼ਿਟਿੰਗ ਵੀ ਕੋਈ ਖਾਸ ਵਧੀਆ ਨਹੀਂ ਸੀ ਅਤੇ ਉਹ ਲੰਬਾਈ ਵੀ ਉਨੀ ਨਹੀਂ ਸੀ ਜਿੰਨੀ ਮੈਨੂੰ ਚਾਹੀਦੀ ਸੀ